ਸਾਡੇ ਸ਼ਹਿਰ ਸਰਹਿੰਦ ਵਿਖੇ ਡਿਸਟ੍ਰਿਕਟ ਲਾਇਬ੍ਰੇਰੀ ਫਤਿਹਗੜ੍ਹ ਸਾਹਿਬ ਮੌਜੂਦ ਹੈ ਇਸ ਦੀ ਸ਼ੁਰੂਆਤ ਉੱਨੀ ਸੌ ਪਚਾਨਵੇਂ ਵਿੱਚ ਹੋਈ ਇਹ ਬਸ ਸਟੈਂਡ ਦੇ ਸਰਹਿੰਦ ਬੱਸ ਸਟੈਂਡ ਦੇ ਬੈਕ ਸਾਈਡ 'ਤੇ ਹੈ ਇਸ ਵਿੱਚ ਉੱਨੀ ਹਜ਼ਾਰ ਤੋਂ ਵੱਧ ਡਾਕੂਮੈਂਟਸ ਉਪਲਬਧ ਹਨ ਇਸ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਇੰਗਲਿਸ਼ ਪੰਜਾਬੀ ਹਿੰਦੀ ਦੇ ਅਖਬਾਰ ਆਉਂਦੇ ਹਨ ਮੇਰੀ ਸਹੇਲੀ ਚੰਪਕ ਚੰਗੀ ਖੇਤੀ ਵਰਗੀਆਂ ਮੈਗਜ਼ੀਨਾਂ ਵੀ ਹਨ ਦੋ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਲਾਇਬ੍ਰੇਰੀ ਦੀ ਮੈਂਬਰਸ਼ਿਪ ਲਈ ਹੋਈ ਹੈ ਮੈਂ ਸਿੱਖ ਇਤਿਹਾਸ ਅਤੇ ਇਤਿਹਾਸ ਦੀਆਂ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਨੂੰ ਪੜ੍ਹਨ ਨੂੰ ਤਰਜੀਹ ਦਿੰਦੀ ਹਾਂ